ਔਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜਿਵੇਂ ਬੱਚੇ ਬਾਹਰ ਨਾ ਜਾ ਸਕਣ ਦੇ ਕਾਰਨ ਬੱਚਿਆਂ ਨੂੰ ਔਨਲਾਈਨ ਕਲਾਸਿਸ ਹੀ ਅਪਣਾਉਣੀਆਂ ਪੈਂਦੀਆਂ ਸਨ ਉਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਕੰਪਿਊਟਰ ਅਤੇ ਮੋਬਾਈਲ 'ਤੇ ਹੀ ਬੀਤਦਾ ਸੀ ਬੱਚਿਆਂ ਦੀਆਂ ਕਲਾਸਾਂ ਵੀ ਫ਼ੋਨ 'ਤੇ ਹੀ ਲੱਗਦੀਆਂ ਸਨ ਜਿਨ੍ਹਾਂ ਕਾਰਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਫ਼ੋਨ ਵਿੱਚ ਹੀ ਰਹਿਣਾ ਪੈਂਦਾ ਸੀ ਜਿਸ ਦੇ ਕਾਰਨ ਉਹਨਾਂ ਦੇ ਮੈਂਟਲ ਹੈਲਥ 'ਤੇ ਵੀ ਬਹੁਤ ਹੀ ਅਸਰ ਹੋਇਆ ਇਸ ਦੇ ਨਾਲ਼ ਉਹ ਬਾਹਰ ਨਾ ਜਾ ਸਕਣ ਦੇ ਕਾਰਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਕੰਪਿਊਟਰ ਅਤੇ ਮੋਬਾਇਲ 'ਤੇ ਹੀ ਬੀਤਦਾ ਸੀ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਬਹੁਤ ਹੀ ਗਲਤ ਪ੍ਰਭਾਵ ਪਿਆ ਔਨਲਾਈਨ ਕਲਾਸਿਸ ਦੀ ਗੱਲ ਕਰੀਏ ਤਾਂ ਇਸ ਦੇ ਦੌਰਾਨ ਬੱਚਿਆਂ ਨੂੰ ਸੈਲਫ ਡਿਸੀਪਲੇਨ ਦੀ ਸਭ ਤੋਂ ਜ਼ਿਆਦਾ ਕਮੀ ਦੇਖਣ ਨੂੰ ਮਿਲੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਦਾ ਇੱਕ ਵਾਤਾਵਰਨ ਮਿਲਦਾ ਹੈ ਜੋ ਕਿ ਘਰ ਵਿੱਚ ਮਿਲਣਾ ਬਹੁਤ ਹੀ ਮੁਸ਼ਕਲ ਸੀ ਇਹੀ ਕਾਰਨ ਹਨ ਕਿ ਕਈ ਵਾਰ ਉਹਨੇ ਕਈ ਵਾਰ ਉਹਨਾਂ ਨੂੰ ਅਸਾਈਨਮੈਂਟ ਕਰਨ ਵਿੱਚ ਵੀ ਬਹੁਤ ਪਰੇਸ਼ਾਨੀ ਹੁੰਦੀ ਸੀ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਚੰਗਾ ਵਾਤਾਵਰਨ ਮਿਲੇ ਅਤੇ ਔਨਲਾਈਨ ਕਲਾਸਿਸ ਨੇ ਉਹਨਾਂ ਦਾ ਸਾਰਾ ਹੀ ਉਹਨਾਂ ਦੇ ਉੱਤੇ ਬਹੁਤ ਹੀ ਪ੍ਰਭਾਵ ਪਾਇਆ